ਹੈਲੋ ਸਤਿ ਸ਼੍ਰੀ ਅਕਾਲ ਹਾਂਜੀ ਜੀ ਬੋਲੋ ਓਕੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਜੋ ਕਿ ਇੱਥੇ ਸਾਰੇ ਗੀ ਦਾ ਘਿਓ ਦਾ ਸਮਾਨ ਬਣਦਾ ਇਹਨਾਂ ਦਾ ਅਤੇ ਇੱਕ ਕਮਲ ਸਵੀਟ ਵੀ ਹੈਗੇ ਨੇ ਤਾਂ ਹੋਰ ਮਲਹੋਤਰਾ ਵੀ ਨੇ ਸਾਰੇ ਬਹੁਤ ਬੈਸਟ ਨੇ ਬਹੁਤ ਹੀ ਜ਼ਿਆਦਾ ਸਪੋਟਿਵ ਨੇ ਬਹੁਤ ਵਧੀਆ ਸਮਾਨ ਮਿਲਦਾ ਹੈ ਇੱਥੇ ਹਾਂਜੀ ਹਾਂਜੀ ਜ਼ਰੂਰ ਜਦੋਂ ਤੁਸੀਂ ਕਹੋਗੇ ਹਾਂਜੀ ਜਦੋਂ ਕੋਲ ਕਰੂੰਗੇ ਕੋਈ ਗੱਲ ਨਹੀਂ ਮੈਂ ਮਿਲ ਲੂੰਗੀ ਤੁਹਾਨੂੰ ਹਾਂਜੀ ਓਕੇ ਜੀ ਓਕੇ